ਜੇਕਰ ਆਪਾਂ ਭਾਰਤ ਵਿੱਚ ਭੋਜਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਪ੍ਰਕਾਰ ਦਾ ਭੋਜਨ ਖਾਧਾ ਜਾਂਦਾ ਹੈ ਜਿਵੇਂ ਕਿ ਪੰਜਾਬ ਵਿੱਚ ਹੀ ਦੇਖ ਲਓ ਪੰਜਾਬ ਵਿੱਚ ਦੁੱਧ ਦਹੀ ਘਿਓ ਮੱਖਣ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੰਜਾਬ ਵਿੱਚ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਬਹੁਤ ਜ਼ਿਆਦਾ ਜ਼ਿਕਰ ਹੁੰਦਾ ਹੈ ਭਰ ਬਹੁਤ ਭਰਪੂਰ ਮਾਤਰਾ ਵਿੱਚ ਖਾਧਾ ਜਾਂਦਾ ਹੈ ਅੱਗੇ ਦੇਖੀਏ ਤਾਂ ਆਪਾਂ ਹਰਿਆਣਾ ਹੈ ਹਰਿਆਣੇ ਵਿੱਚ ਵੀ ਲੋਕ ਦੁੱਧ ਦਹੀ ਲੱਸੀ ਦਾ ਬਹੁਤ ਜ਼ਿਆਦਾ ਅ ਪ੍ਰਯੋਗ ਕਰਦੇ ਹਨ ਅੱਗੇ ਆਪਾਂ ਦੇਖੀਏ ਤਾਂ ਜਿਵੇਂ ਸਮੁੰਦਰ ਨਾਲ ਛਟੇ ਹੋਏ ਖੇਤਰ ਹੈ ਭਾਰਤ ਦੇ ਉੱਥੇ ਜ਼ਿਆਦਾਤਰ ਮੱਛਲੀ ਦਾ ਯੂਜ਼ ਕੀਤਾ ਜਾਂਦਾ ਹੈ ਖਾਣ ਲਈ ਔਰ ਚੌਲਾਂ ਦਾ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕੇਰਲਾ ਹੈ ਉੜੀਸਾ ਹੈ ਪਸ਼ਚਿਮ ਬੰਗਾਲ ਹੈ ਇਹਨਾਂ ਸਾਰੀਆਂ ਥਾਵਾਂ 'ਤੇ ਹੀ ਮੱਛਲੀ ਚੌਲਾਂ ਦਾ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਖਾਣ ਲਈ